ਭਾਰਤ ਦੇ ਮਸ਼ਹੂਰ ਫੋਟੋਗ੍ਰਾਫਰ ਇਹ ਹਨ ਰਘੂ ਰਾਏ ਅ ਪੁਸ਼ਕਾਂ ਵਾਲਾ ਰਾਮ ਰਹਿਮਾਨ ਸੁਨੀਲ ਗੁਪਤਾ ਗੋਰੀ ਗਿੱਲ ਇਹ ਜਿਹੜੇ ਇਹ ਫੋਟੋਗ੍ਰਾਫਰ ਨੇ ਮੈਂ ਇਹਨਾਂ ਦੀ ਹੀ ਪਾਲਣਾ ਕਰਦਾ ਹਾਂ ਕਿਉਂਕਿ ਜਿਹੜੇ ਇਹ ਫੋਟੋਗ੍ਰਾਫਰ ਨੇ ਬਹੁਤ ਹੀ ਵਧੀਆ ਫੋਟੋਗ੍ਰਾਫੀ ਕਰਦੇ ਨੇ